ਸਾਡੀ ਰਸੋਈ ਦੇ ਵਿੱਚ ਬਹੁਤ ਸਾਰੇ ਭਾਂਡੇ ਹਨ ਪਰ ਕੁਝ ਭਾਂਡੇ ਮੈਨੂੰ ਨਹੀਂ ਪਸੰਦ ਲੱਗਦੇ ਕਿਉਂਕਿ ਉਹ ਮੇਰੇ ਲਈ ਬਹੁਤ ਹੀ ਮੈਂ ਉਨ੍ਹਾਂ ਨੂੰ ਚੰਗਾ ਨਹੀਂ ਸਮਝਦੀ ਕਿਉਂਕਿ ਕੁਝ ਭਾਂਡੇ ਅਜਿਹੇ ਹਨ ਜਿਸ ਵਿੱਚ ਸਬਜ਼ੀ ਕੁਛ ਵੀ ਬਣਾਇਆ ਜਾਵੇ ਅਤੇ ਉਹ ਥੱਲੇ ਲੱਗ ਜਾਂਦਾ ਹੈ ਜਿਵੇਂ ਕਿ ਪਤੀਲਾ ਜੋ ਕਿ ਬਹੁਤ ਹੀ ਬੁ ਮੈਨੂੰ ਯਾਦ ਹੈ ਮੇਰੇ ਲਈ ਬਹੁਤ ਹੀ ਬੁਰਾ ਐਕਸਪੀਰੀਐਂਸ ਸੀ ਅਤੇ ਜਦੋਂ ਓਹ ਓਸ ਵਿੱਚ ਮੈਂ ਇੱਕ ਵਾਰ ਚਾਵਲ ਬਣਾਏ ਅਤੇ ਉਹ ਸਾਰੇ ਥੱਲੇ ਲੱਗ ਗਏ ਸੀ ਮੈਨੂੰ ਲੱਗਦਾ ਹੈ ਕਿ ਉਹ ਮੇਰੇ ਲਈ ਬਹੁਤ ਹੀ ਮਾੜਾ ਐਕਸਪੀਰੀਐਂਸ ਸੀ ਇਸ ਕਰਕੇ ਮ ਭਾਂਡੇ ਤਾਂ ਹੋਰ ਵੀ ਬਹੁਤ ਸਾਰੇ ਹਨ ਪਰ ਮੈਨੂੰ ਲੱਗਦਾ ਹੈ ਕਿ ਉਹ ਪਤੀਲਾ ਮੇਰਾ ਲਈ ਠੀਕ ਨਹੀਂ ਹੈ